ਲਾਈਟ ਪ੍ਰਦੂਸ਼ਣ ਨੇ ਸਟਾਰਗੇਜ਼ਿੰਗ ਨੂੰ ਕਾਫੀ ਪ੍ਰਕਾਰ ਨਾਲ ਪ੍ਰਭਾਵਿਤ ਕੀਤਾ ਹੈ ਜਿਵੇਂ ਕਿ ਜਦੋਂ ਰਾਤ ਨੂੰ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਲਾਈਟਾਂ ਜਗ੍ਹਾ ਕੇ ਉਹ ਲੋਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ ਇਸ ਨਾਲ ਜੰਗ ਜੰਗਲੀ ਜਾਨਵਰਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਐਂ ਲੱਗਦਾ ਹੈ ਕਿ ਇਹ ਸੂਰਜ ਦੀ ਰੋਸ਼ਨੀ ਹੈ ਅਤੇ ਇਸ ਨਾਲ ਉਹ ਕਈ ਵਾਰ ਜੰਗਲ ਤੋਂ ਬਾਹਰ ਆ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਵੀ ਕਾਫੀ ਦਿੱਕਤ ਹੁੰਦੀ ਹੈ ਅਤੇ ਲੋਕਾਂ ਨੂੰ ਵੀ ਕਾਫੀ ਦਿੱਕਤ ਹੁੰਦੀ ਹੈ ਅਤੇ ਇਸ ਨਾਲ ਕਾਰਬਨ ਡਾਈਆਕਸਾਈਡ ਦੀ ਖਪਤ ਵੀ ਕਾਫੀ ਵੱਧ ਜਾਂਦੀ ਹੈ ਅਤੇ ਇਸ ਨਾਲ ਅਸਮਾਨ ਵਿੱਚ ਤਾਰਿਆਂ ਦੇਖਣ ਵਿੱਚ ਵੀ ਕਾਫੀ ਦਿੱਕਤ ਦਾ ਸਾਹਮਨਾ ਕਰਨਾ ਪੈਂਦਾ ਹੈ ਅਤੇ ਅਸੀਂ ਸੰਤੁਸ਼ਟ ਅਤੇ ਅਸੀਂ ਆਪਣੇ ਇਲਾਕੇ ਵਿੱਚ ਸਾਫ ਆਸਮਾਨ ਦੇਖ ਸਕਦੇ ਹਾਂ ਕਿਉਂਕੀ ਮੈਂ ਮੁਕਤਸਰ ਸ਼ਹਿਰ ਦਾ ਰਹਿਣ ਵਾਲਾ ਹਾਂ ਜੋ ਕਿ ਪੰਜਾਬ ਦੇ ਵਿੱਚ ਪੈਂਦਾ ਹੈ ਇਹ ਥੋੜ੍ਹਾ ਅਰਧ ਅਰਧ ਸ਼ਹਿਰੀ ਇਲਾਕਾ ਹੈ ਅਤੇ ਮੈਂ ਇਸ ਦੇ ਥੋੜ੍ਹੇ ਬਾਜ਼ਾਰ ਤੋਂ ਦੂਰ ਰਹਿੰਦਾ ਹਾਂ ਇਸ ਕਰਕੇ ਇੱਥੇ ਵੀ ਥੋੜ੍ਹਾ ਅ ਅਸਮਾਨ ਸਾਫ ਹੈ ਜਿਸ ਕਾਰਨ ਮੈਂ ਅਸਮਾਨ ਦੇ ਵਿੱਚ ਤਾਰੇ ਦੇਖ ਸਕਦਾ ਹਾਂ ਅਤੇ ਇਸ ਇਸ ਤੋਂ ਸਪਸ਼ਟਤਾ ਰਹਿਣ ਦੀ ਨਿਰੀਖਣ ਕਰਨ ਲਈ ਅਸੀਂ ਇਹ ਮੈਂ ਆਪਣੇ ਘਰ ਵਿੱਚ ਹੀ ਬੈਠ ਕੇ ਤਾਰੇ ਦੇਖ ਸਕਦਾ ਹਾਂ ਇਸ ਨਾਲ ਮੈਨੂੰ ਤਾਰੇ ਵੀ ਆਸਾਨੀ ਨਾਲ ਦਿੱਖ ਜਾਂਦੇ ਹੈ ਅਤੇ ਮੈਨੂੰ ਕਿਤੇ ਦੂਰ ਜਗ੍ਹਾ ਵੀ ਨਹੀਂ ਜਾਣਾ ਪੈਂਦਾ ਜਿੱਥੇ ਲਾਈਟ ਨਾ ਹੋਵੇ ਕਿਉਂਕੀ ਇੱਥੇ ਪਹਿਲਾਂ ਤੋਂ ਹੀ ਲਾਈਟ ਕਾਫੀ ਘੱਟ ਹੈ ਅਤੇ ਬਾਜ਼ਾਰ ਵਾਲੇ ਪਾਸੇ ਜਾਨ ਸਮੇਂ ਉੱਥੇ ਲਾਈਟ ਕਾਫੀ ਵੱਧ ਜਾਂਦੀ ਹੈ ਇਸ ਕਾਰਨ ਮੈਨੂੰ ਇੱਥੇ ਬੈਠ ਕੇ ਹੀ ਤਾਰੇ ਦੇਖਣਾ ਵਧੀਆ ਲੱਗਦਾ ਹੈ ਅਤੇ ਇਸ ਨਾਲ ਪ੍ਰਦੂਸ਼ਣ ਵਿਕਾਸ ਜ਼ਿਆਦਾ ਨਹੀਂ ਹੁੰਦਾ